ਹੈਲੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਦਸ਼ਮੇਸ਼ ਬੱਸ ਬਠਿੰਡਿਓਂ ਬੋਲਦੇ ਹੋ ਜੀ ਸਾਨੂੰ ਜੀ ਹਾਂਜੀ ਸਾਨੂੰ ਨਾ ਇਹ ਟੂਰਿਸਟ ਵਾ ਯਾਤਰਾ 'ਤੇ ਬੱਸ ਚਾਹੀਦੀ ਸੀਗੀ ਜੀ ਬਠਿੰਡੇ ਤੋਂ ਲੈ ਕੇ ਅਸੀਂ ਅੰਮ੍ਰਿਤਸਰ ਜਾਣਾ ਜੀ ਹਾਂਜੀ ਚਾਲੀ ਸਵਾਰੀਆਂ ਹੈਗੀਆ ਚਾਲੀ ਪੰਤਾਲੀ ਅੱਛਾ ਜੀ ਹਾਂਜੀ ਬਠਿੰਡੇ ਤੋਂ ਜਾਣਾ ਅੰਮ੍ਰਿਤਸਰ ਜੀ ਬੱਸ ਏ ਸੀ ਹੋਊਗੀ ਜੀ ਹਾਂਜੀ ਅਸੀਂ ਕੱਲ੍ਹ ਤੱਕ ਜਾਣਾ ਜੀ ਕੱਲ੍ਹ ਨੂੰ ਸ਼ਾਮ ਨੂੰ ਤੁਰਨਾ ਬਠਿੰਡਿਓਂ ਠੀਕ ਹੈ ਜੀ ਬੱਸ ਵਧੀਆ ਹੋਣੀ ਚਾਹੀਦੀ ਹੈ ਜੀ ਬੱਸ ਮੈਂ ਕਿਹਾ ਵਧੀਆ ਹੋਣੀ ਚਾਹੀਦੀ ਹੈ ਜੀ ਸਰਵਿਸ ਸੁਰਵਿਸ ਵਧੀਆ ਹੋਣੀ ਚਾਹੀਦੀ ਠੀਕ ਹੈ ਜੀ ਚੱਲ ਅਸੀਂ ਤੁਹਾਨੂੰ ਸ਼ਾਮ ਨੂੰ ਫੋਨ ਲਾਈਏ ਜੀ

ਠੀਕ ਹੈ ਜੀ ਅਤੇ ਕੀ ਕਿੰਨੇ ਪੈਸੇ ਲੱਗਣਗੇ ਜੀ ਕਿਲੋਮੀਟਰ ਦੇ ਹਿਸਾਬ ਨਾਲ ਲਓਂਗੇ ਕਿ ਸਿੱਧਾ ਟਰਿਪ ਦੇ ਲਓਂਗੇ ਠੀਕ ਹੈ ਜੀ ਠੀਕ ਆ ਓਕੇ ਬਾਈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਆ ਬਠਿੰਡਿਓਂ ਤੁਰਨਾ ਵਾ ਬਠਿੰਡੇ ਹੀ ਆਉਣਾ ਹੈ ਜੀ ਚਲੋ ਠੀਕ ਹੈ ਓਕੇ ਜੀ ਧੰਨਵਾਦ